ਭਾਰਤ ਵਿੱਚ ਰਾਜਨੀਤੀ ਅਤੇ ਸਿਆਸੀ ਪਾਰਟੀਆਂ ਬਹੁਤ ਹਨ ਜਿਨ੍ਹਾਂ ਵਿੱਚੋਂ ਬੀ ਜੇ ਪੀ ਆਈ ਐੱਨ ਸੀ ਸੀ ਪੀ ਆਈ ਬਹੁਜਨ ਸਮਾਜ ਪਾਰਟੀ ਆਦਿ ਅਤੇ ਹੋਰ ਵੀ ਕਈ ਪਾਰਟੀਆਂ ਮੌਜੂਦ ਹਨ ਭਾਰਤ ਇੱਕ ਲੋਕਤੰਤਰ ਦੇਸ਼ ਹੈ ਇਸ ਵਿੱਚ ਹਰ ਇੱਕ ਇਨਸਾਨ ਚਾਹੇ ਅਮੀਰ ਹੋਵੇ ਗਰੀਬ ਹੋਵੇ ਉਸਕਾ ਉਸ ਦਾ ਅਧਿਕਾਰ ਬਰਾਬਰ ਹੈ ਲੋਕਤੰਤਰ ਰਾਜ ਵਿੱਚ ਆਮ ਜਨਤਾ ਹੀ ਸਿਆਸੀ ਪਾਰਟੀਆਂ ਨੂੰ ਵੋਟਾਂ ਰਾਹੀਂ ਜਿਤਾਉਂਦੀ ਹੈ ਉਸਨੂੰ ਇਹ ਅਧਿਕਾਰ ਹੈ ਕਿ ਉਹ ਵੋਟ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਨੂੰ ਚੁਣ ਸਕਦਾ ਹੈ ਇਹਦੇ ਵਿੱਚ ਕੋਈ ਪਾਬੰਦੀ ਨਹੀਂ ਹੈ ਅਤੇ ਲੋਕ ਲੋਕਾਂ ਦੀ ਰਾਏ ਦੇ ਅਨੁਸਾਰ ਹੀ ਜੋ ਸਿਆਸੀ ਪਾਰਟੀਆਂ ਦੇ ਲੀਡਰ ਨੇਤਾ ਸਭ ਚੁਣੇ ਜਾਂਦੇ ਹਨ ਲੋਕਤੰਤਰ ਰਾਜ ਵਿੱਚ ਅਜ਼ਾਦੀ ਹੈ ਅਤੇ ਇਸ ਵਿੱਚ ਨਾ ਪਸੰਦ ਚੀਜ਼ ਇਹ ਹੀ ਹੈ ਕਿ ਰਾਜ ਦੇ ਵਿੱਚ ਬੇਰੁਜ਼ਗਾਰੀ ਹੈ ਜਿਹੜੀ ਕਿ ਜੋ ਕਿ ਨਾਪਸੰਦ ਚੀਜ਼ ਹੈ ਬੇਰੁਜ਼ਗਾਰੀ ਤੋਂ ਇਲਾਵਾ ਇਸ ਵਿੱਚ ਗਰੀਬੀ ਅਤੇ ਅਨਪੜ੍ਹਤਾ ਵੀ ਬਹੁਤ ਜ਼ਿਆਦਾ ਫੈਲੀ ਹੋਈ ਹੈ ਜਿਸ ਕਾਰਣ ਕਾ ਭਾਰਤ ਦੇ ਕਾਫ਼ੀ ਲੋਕ ਗਰੀਬ ਹਨ ਜਾਂ ਅਨਪੜ੍ਹ ਹਨ ਜਿਨ੍ਹਾਂ ਨੂੰ ਮਤਲਬ ਪੜ੍ਹਨ ਦੀ ਕੋਈ ਸੁਵਿਧਾ ਨਹੀਂ ਹੈ ਅਸੀਂ ਆਪਣੇ ਆਪਣੇ ਏਰੀਏ ਦੇ ਐੱਮ ਐੱਲ ਏ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਹਨ ਉਹਨਾਂ ਨੂੰ ਮਿਲਣਾ ਚਾਹਵਾਂਗੇ ਅਤੇ ਜੇ ਕਿਤੇ ਉਹਨਾਂ ਨੂੰ ਮਿਲਣ ਦੀ ਕੋਈ ਮੌਕਾ ਮਿਲਿਆ ਤਾਂ ਅਸੀਂ ਉਸਨੂੰ ਇਹ ਹੀ ਕਹਿਣਾ ਚਾਹਵਾਂਗੇ ਕਿ ਜੋ ਆਪਣੇ ਇਲਾਕੇ ਦੇ ਵਿੱਚ ਗਰੀਬੀ ਅਤੇ ਅਨਪੜ੍ਹਤਾ ਬੇਰੁਜ਼ਗਾਰੀ ਨਸ਼ੇ ਹਨ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਨੂੰ ਉਹਨਾਂ ਦੀ ਰੋਕਥਾਮ ਦੇ ਲਈ ਜਨਤਾ ਨੂੰ ਮਤਲਬ ਸੁਵਿਧਾ ਪ੍ਰਦਾਨ ਕੀਤੀ ਜਾਵੇ